ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੈਟਰੋਲ ਦੀਆਂ ਵਧੀਆ ਕੀਮਤਾਂ ਮੇਰੇ ਬਾਈਕਿੰਗ 'ਤੇ ਬਹੁਤ ਜ਼ਿਆਦਾ ਪ੍ਰਭਾਵ ਕਰਦੀਆਂ ਹਨ ਕਿਉਂਕਿ ਕਿਤੇ ਵੀ ਸਾਨੂੰ ਜਾਣ ਵਾਸਤੇ ਬਾਈਕ ਦੀ ਲੋੜ ਪੈਂਦੀ ਹੈ ਅਤੇ ਅਗਰ ਪੈਟਰੋਲ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਸਾਡੇ ਆਮਦਨ ਦੇ ਬਜਟ 'ਤੇ ਬਹੁਤ ਅਸਰ ਪੈਂਦਾ ਹੈ ਕਈ ਵਾਰ ਤਾਂ ਪਿੰਡਾਂ ਦੇ ਖੇਤਰਾਂ ਵਿੱਚ ਹੋਰ ਸਥਾਨ ਨਾ ਹੋਣ ਕਰਕੇ ਵੀ ਬਾਈਕ ਦੀ ਜ਼ਰੂਰਤ ਪੈਂਦੀ ਹੈ ਅਤੇ ਜ਼ਿਆਦਾਤਰ ਘਰਾਂ ਵਿੱਚ ਮਜ਼ਦੂਰ ਹਨ ਇਸ ਲਈ ਇਸ ਦੀਆਂ ਕੀਮਤਾਂ ਨਹੀਂ ਵਧਣੀਆਂ ਚਾਹੀਦੀਆਂ ਦੂਸਰਾ ਇਸ ਨਾਲ ਇੱਕ ਹੋਰ ਹੀ ਹੈ ਕੀ ਅਗਰ ਪੈਟਰੋਲ ਡੀਜਲ ਜਾਂ ਹੋਰ ਤੌਰ 'ਤੇ ਬਦਲਣ ਦੀ ਜ਼ਿਆਦਾ ਵਰਤੋਂ ਵਾਤਾਵਰਣ 'ਤੇ 'ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ ਗੱਡੀਆਂ ਕਾਰਾਂ ਬਾਇਕ ਫੈਕਟਰੀਆਂ ਦਾ ਧੂੰਆਂ ਵੀ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਅਤੇ ਇਸ ਨਾਲ ਵਾਤਾਵਰਨ ਵਿਚਲੀ ਹਵਾ ਗੰਦਗੀ ਤੋਂ ਹੋ ਜਾਂਦੀ ਹੈ ਅਤੇ ਜਦੋਂ ਅਸੀਂ ਇਸ ਤਰ੍ਹਾਂ ਵੀ ਸਾਹ ਲੈਂਦੇ ਹਾਂ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਸਾਹ ਨਾਲ ਸੰਬੰਧਿਤ ਬਿਮਾਰੀਆਂ ਹੋ ਸਕਦੀਆਂ ਹਨ ਘਰਾਂ ਵਿੱਚ ਘਰਾਂ ਵਿੱਚ ਵੀ ਅਸੀਂ ਖਾਣਾ ਬਣਾਉਣ ਬਣਾਉਣ ਲਈ ਅਕਸਰ ਬਾਲਣ ਦੀ ਵਰਤੋਂ ਕਰਦੇ ਹਾਂ ਇਸ ਦਾ ਧੂੰਆਂ ਵੀ ਨੁਕਸਾਨ ਪਹੁੰਚਾਉਂਦਾ ਹੈ ਕਈ ਵਾਰ ਕਿਸਾਨ ਖੇਤਾਂ ਵਿਚਲੀ ਪਰਾਲੀ ਨੂੰ ਅੱਗ ਲਾਉਂਦਾ ਹੈ ਉਸ ਨਾਲ ਵੀ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਇਹ ਸਾਰੇ ਜਿਹੜੇ ਕਾਰਨ ਐ ਵਾਤਾਵਰਨ ਦੇ ਪ੍ਰਭਾਵਿਤ ਕਰਦੇ ਹਨ